ਜ਼ਿਆਦਾਤਰ ਮੈਂ ਜੋ ਦੇਖਿਆ ਹੈ ਉਹ ਇਹ ਹੈ ਕਿ ਮੈਨੂੰ ਬਹੁਤ ਲੇਖ ਇਦਾਂ ਦੇ ਮਿਲੇ ਹਨ ਜੋ ਕਿ ਮੈਂ ਹਿੰਦੀ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਕੀਤੇ ਹਨ ਅਤੇ ਉਸਦਾ ਅਨੁਭਵ ਇਹ ਕਿਹਾ ਜਾ ਸਕਦਾ ਹੈ ਕਿ ਹਿੰਦੀ ਦੇ ਵਿੱਚੋਂ ਪੜ੍ਹ ਕੇ ਪੰਜਾਬੀ ਦੇ ਵਿੱਚ ਅਨੁਵਾਦ ਕਰਨਾ ਹੈ ਤਾਂ ਔਖਾ ਪਰ ਉਹਦੇ ਵਿੱਚ ਕਾਰਨ ਇਹ ਹੈ ਵੀ ਕੁਝ ਹਿੰਦੀ ਦੇ ਸ਼ਬਦ ਇੱਦਾਂ ਦੇ ਹੁੰਦੇ ਹਨ ਉਹ ਹਿੰਦੀ ਦੇ ਵਿੱਚ ਕੁਝ ਹੋਰ ਬੋਲਿਆ ਜਾਂਦਾ ਹੈ ਪੰਜਾਬੀ ਦੇ ਵਿੱਚ ਉਹਨਾਂ ਨੂੰ ਕੁਝ ਹੋਰ ਬੋਲਿਆ ਜਾਂਦਾ ਹੈ ਇਸ ਕਰਕੇ ਉਹ ਸ਼ਬਦ ਲੱਭਣੇ ਪੰਜਾਬੀ ਦਾ ਭਾਸ਼ਾ ਦਾ ਉਹ ਸ਼ਬਦ ਲੱਭਣਾ ਵੀ ਇਹਨੂੰ ਹਿੰਦੀ ਨੂੰ ਪੰਜਾਬੀ ਦੇ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ਇਹ ਇਹੋ ਜਿਹੇ ਅਨੁਭਵ ਬਹੁਤ ਜ਼ਿਆਦਾ ਹੁੰਦੇ ਰਹਿੰਦੇ ਹਨ ਇਸ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਹਿੰਦੀ ਥੋੜ੍ਹੇ ਜਿਹੇ ਵੱਧ ਜਗ੍ਹਾ ਰੋਕਦੀ ਹੈ ਜੋ ਕਿਸੇ ਪੇਜ 'ਤੇ ਲਿਖਣਾ ਹੋਵੇ ਤਾਂ ਉਹ ਥੋੜ੍ਹਾ ਜਿਹਾ ਸਪੇਸ ਜਿਹੜੀ ਇੱਕ ਜਗ੍ਹਾ ਉਹ ਵੱਧ ਲੈਂਦੀ ਹੈ ਪੇਜ ਦੀ ਅਤੇ ਪੰਜਾਬੀ ਉਸ ਤੋਂ ਘੱਟ ਲੈਂਦੀ ਹੈ ਇਸ ਕਰਕੇ ਜੇ ਕੁਝ ਤੁਸੀਂ ਹਿੰਦੀ ਦੇ ਵਿੱਚ ਕਿਤਾਬ ਲਿਖਣੀ ਹੈ ਤਾਂ ਉਹ ਵੱਧ ਪੇਜਾਂ ਦੀ ਬਣਦੀ ਹੈ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਉਹੀ ਕਿਤਾਬ ਲਿਖਣੀ ਹੈ ਤਾਂ ਘੱਟ ਪੇਜਾਂ ਦੀ ਬਣੇਗੀ